ਵਹਿਮਾਂ ਭਰਮਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਭਾਰਤ ਜਿਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਇਹਨਾਂ ਸਾਰਿਆਂ ਦੇ ਮਾਨਣਾ ਅਤੇ ਨਾ ਮੰਨਣਾ ਅਲੱਗ ਅਲੱਗ ਹੈ ਜਿੱਦਾਂ ਕਿ ਇੱਕ ਮੁੰਡਾ ਜਿਹੜਾ ਹਿੰਦੂ ਧਰਮ ਤੋਂ ਹੈ ਉਹ ਇਹ ਸੋਚਦਾ ਹੈ ਕਿ ਜਿਵੇਂ ਬਿੱਲੀ ਇੱਕ ਰਸਤਾ ਕੱਟ ਜਾਵੇ ਰਾਤ ਨੂੰ ਕੁੱਤੇ ਦਾ ਰੋਣਾ ਇਹ ਸਾਰੇ ਵਹਿਮ ਹਨ ਅਤੇ ਜਾਅਲੀ ਬਾਬਿਆਂ ਨੂੰ ਦਾ ਆਪਣਾ ਰੱਬ ਬਣਾਉਣਾ ਇਹ ਸਾਰੇ ਵਹਿਮਾਂ ਵਿੱਚ ਆਉਂਦੇ ਨੇ ਸਾਡੇ ਲੋਕ ਇਹ ਵਹਿਮਾਂ ਭਰਮਾਂ ਨੂੰ ਇੰਨਾ ਮਨ ਜਾਂਦੇ ਹਨ ਕਿ ਉਹ ਆਪਣਾ ਸਾਰੀ ਜ਼ਿੰਦਗੀ ਇੱਥੇ ਬਤੀਤ ਕਰ ਦਿੰਦੇ ਹਨ ਜਿਵੇਂ ਕਿ ਰੱਬ ਨੂੰ ਨਾ ਮੰਨਣਾ ਨਾਸਤਿਕ ਹੋਣਾ ਅਤੇ ਮਾਸ ਮੱਛੀ ਖਾਣਾ ਕਈ ਲੋਕ ਇਹ ਸੋਚਦੇ ਹਨ ਕਿ ਮਾਸ ਮੱਛੀ ਖਾਣ ਵਾਲੇ ਲੋਕ ਨੇ ਰਾਕਸ਼ਸ ਹੁੰਦੇ ਹਨ ਇਹ ਸਾਰੀਆਂ ਵਹਿਮਾਂ ਭਰਮਾਂ ਦੀ ਚੀਜ਼ਾਂ ਹਨ ਜੋ ਕਿ ਇੰਟਰਨੈਟ ਦੇ ਰਾਹੀਂ ਕਾਫੀ ਤੇਜ਼ੀ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿਸੇ ਨੂੰ ਵੀ ਇੱਦਾਂ ਨਹੀਂ ਕਹਿਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦਾ ਮਾਨਣਾ ਨਾ ਮੰਨਣਾ ਅਲੱਗ ਅਲੱਗ ਹੈ